ਮੈਂ ਬਠਿੰਡੇ ਤੋਂ ਰਾਮਾ ਮੰਡੀ ਜਾਣ ਲਈ ਇੱਕ ਕੈਬ ਬੁੱਕ ਕਰਵਾਈ ਸੀ ਜੋ ਕੈਬ ਦੇ ਪਹੁੰਚਣ ਦਾ ਅਸਲੀ ਟਾਈਮ ਸੀ ਉਸ ਸਮੇਂ 'ਤੇ ਕੈਬ ਨਹੀਂ ਪਹੁੰਚੀ ਤਾਂ ਮੈਨੂੰ ਦੇਰ ਹੁੰਦੀ ਦਿਖੀ ਤਾਂ ਮੈਂ ਕੈਬ ਨੂੰ ਕੈਂਸਲ ਕਰਨ ਬਾਰੇ ਸੋਚਿਆ ਕਿਉਂਕਿ ਜੇਕਰ ਮੈਂ ਕੈਬ ਦਾ ਹੋਰ ਜ਼ਿਆਦਾ ਇੰਤਜਾਰ ਕਰਦੀ ਸੀ ਤਾਂ ਮੈਂ ਆਪਣੇ ਕੰਮ ਤੋਂ ਲੇਟ ਹੋ ਜਾਣਾ ਸੀ ਇਸ ਲਈ ਮੇਰੇ ਕੋਲ ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਤਾਂ ਮੈਂ ਇਹ ਸੋਚਿਆ ਕਿ ਇਹ ਕੈਬ ਕੈਂਸਲ ਕਰ ਦਿੱਤੀ ਜਾਵੇ ਅਤੇ ਆਪਣੇ ਘਰੋਂ ਕਿਸੇ ਵਹੀਕਲ 'ਤੇ ਜਾਇਆ ਜਾਵੇ ਇਸ ਲਈ ਕੈਬ ਦੇ ਦੇਰ ਨਾਲ ਆਉਣ ਦਾ ਜੋ ਕਾਰਨ ਸੀ ਉਹ ਮੇਰੇ ਦੁਆਰਾ ਕੈਬ ਕੈਂਸਲ ਕਰਨ ਦਾ ਕਾਰਨ ਬਣ ਗਿਆ ਅਤੇ ਮੈਂ ਇਸ ਕੈਬ ਨੂੰ ਕੈਂਸਲ ਕਰ ਦਿੱਤਾ ਅਤੇ ਇਸ ਲਈ ਮੈਂ ਆਪਣੇ ਘਰ ਜਿੱਥੇ ਵੀ ਜਾਣਾ ਸੀ ਆਪਣੇ ਵਹੀਕਲ 'ਤੇ ਚਲੀ ਗਈ ਤਾਂ ਪਹਿਲੀ ਵਾਰ ਮੈਂ ਇੱਕ ਕੈਬ ਬੁੱਕ ਕੀਤੀ ਸੀ ਅਤੇ ਕੈਬ ਦਾ ਜੋ ਮੇਰਾ ਅਨੁਭਵ ਹੈ ਕੋਈ ਬਹੁਤਾ ਚੰਗਾ ਨਹੀਂ ਰਿਹਾ ਹਾਂ ਜੇਕਰ ਕੈਬ ਸਹੀ ਟਾਈਮ 'ਤੇ ਆਉਂਦੀ ਤਾਂ ਹੋ ਸਕਦਾ ਹੈ ਕਿ ਮੇਰਾ ਕੈਬ ਦਾ ਅਨੁਭਵ ਤਜਰਬਾ ਬਹੁਤ ਵਧੀਆ ਰਹਿੰਦਾ ਪਰ ਅਫ਼ਸੋਸ ਮੈਨੂੰ ਇਹ ਕੈਬ ਕੈਂਸਲ ਕਰਨੀ ਪੈ ਗਈ